ਸਾਡੇ ਸਥਾਨਕ ਖੇਤਰਾਂ ਦੇ ਵਿੱਚ ਖਾਸ ਕਰ ਸਾਡੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿੱਚ ਕਾਫੀ ਜੋ ਕਿ ਮੀਡੀਆ ਆਊਟਲੈਟਸ ਜਾਣਕਾਰੀ ਦੇ ਸਰੋਤ ਜੋ ਕਿ ਜ਼ਿਆਦਾਤਰ ਲੋਕਾਂ ਦੇ ਘਰਾਂ ਦੇ ਵਿੱਚ ਅਖ਼ਬਾਰਾਂ ਜਰੀਏ ਹੀ ਮੀਡੀਆ ਦੀ ਜੋ ਰਿਪੋਰਟਾਂ ਪਹੁੰਚਦੀਆਂ ਹਨ ਪੂਰੇ ਦੁਨੀਆ ਭਰ ਦੀਆਂ ਖਬਰਾਂ ਪਹੁੰਚਦੀਆਂ ਹਨ ਕਾਫੀ ਅਖ਼ਬਾਰਾਂ ਜਿਹੜੀਆਂ ਮਸ਼ਹੂਰ ਹਨ ਜਿਵੇਂ ਕਿ ਜਗਬਾਣੀ ਜਾਗਰਣ ਦੈਨਿਕ ਅਤੇ ਅਜੀਤ ਅਤੇ ਹਿੰਦੀ ਅਖ਼ਬਾਰਾਂ ਵੀ ਕਈ ਲੋਕ ਪੜ੍ਹਨਾ ਪਸੰਦ ਕਰਦੇ ਹਨ ਅਤੇ ਅ ਖਾਸ ਕਰ ਸਾਡੇ ਜ਼ਿਲ੍ਹੇ ਦੇ ਵਿੱਚ ਅਜੀਤ ਅਖ਼ਬਾਰ ਸਾਰੇ ਹੀ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਵਿੱਚ ਬੋਲੀ ਜਾਂਦੀ ਹੈ ਇਹ ਇੱਕ ਪੰਜਾਬੀ ਭਾਸ਼ਾ ਦੇ ਵਿੱਚ ਅਖ਼ਬਾਰ ਆਉਂਦੀ ਹੈ ਅਤੇ ਇਹਦੇ ਵਿੱਚ ਲਗਭਗ ਅੱਠ ਪੇਜ ਹੁੰਦੇ ਹਨ ਨਾਲ ਇੱਕ ਖੇਡ ਵਾਲਾ ਪੇਜ ਵੀ ਹੁੰਦਾ ਹੈ ਇੱਕ ਖੇਤਰ ਲੋਕਲ ਜਿਵੇਂ ਕਿ ਤਹਿਸੀਲਾਂ ਜਿਵੇਂ ਕਿ ਬਲਾਚੋਰ ਸੜੋਆ ਬਲੋਕ ਰਾਹੋਂ ਬਲੋਕ ਬੰਗਾ ਬਲੋਕ ਇੱਦਾਂ ਦੀ ਜਿਹੜੇ ਬਲੋਕ ਹਨ ਇਹਨਾਂ ਦੀ ਖ਼ਬਰਾਂ ਵੀ ਅਲੱਗ ਅਲੱਗ ਆਉਂਦੀਆਂ ਹਨ ਅਤੇ ਕ ਲੋਕ ਇਹਨੂੰ ਕਾਫੀ ਪਸੰਦ ਕਰਦੇ ਹਨ